ਜੀ ਹਾਂ ਬਿਲਕੁਲ ਸਾਨੂੰ ਪਾਣੀ ਦੀ ਸਪਲਾਈ ਨਿਰਵਿਘਨ ਮਿਲਦੀ ਹੈ ਅਸੀਂ ਜੋ ਟੂਟੀ ਦਾ ਪਾਣੀ ਹੈ ਜ਼ਿਆਦਾਤਰ ਉਹੀ ਪਾਣੀ ਵਰਤਦੇ ਹਾਂ ਅੱਜ ਕੱਲ੍ਹ ਦੇ ਦੌਰ ਵਿੱਚ ਵਿੱਚ ਜਿੱਥੇ ਬਿਮਾਰੀਆਂ ਇੰਨੀਆਂ ਵੱਧ ਗਈਆਂ ਹਨ ਜਿੰਨਾ ਨਵੀਨੀਕਰਨ ਹੋ ਰਿਹਾ ਹੈ ਉਹਦੇ ਕਰਕੇ ਕੈਮੀਕਲ ਵਾਲਾ ਜਿਹੜਾ ਗੰਦ ਬੁਲਾਈ ਫੈਕਟਰੀਆਂ 'ਚੋਂ ਨਿਕਲਦੀਆਂ ਹਨ ਉਹ ਸਾਰਾ ਕੁਝ ਹੀ ਪਾਣੀ ਵਿੱਚ ਮਿਲ ਕੇ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ ਇਸੇ ਕਰਕੇ ਲੋਕਾਂ ਨੇ ਅੱਜ ਕੱਲ੍ਹ ਪਾਣੀ ਉਬਾਲ ਕੇ ਜਾਂ ਟੂਟੀ ਦਾ ਪਾਣੀ ਨਾ ਪੀ ਕੇ ਐਕਓਗਾਡ ਜਾਂ ਫਿਲਟਰ ਲਗਵਾਉਣਾ ਪਸੰਦ ਕਰਦੇ ਹਨ ਪਹਿਲਾਂ ਜ਼ਾਮਾਨਿਆਂ ਵਿੱਚ ਜਦੋਂ ਜ਼ਿੰਦਗੀ ਬਹੁਤ ਹੀ ਸਧਾਰਨ ਹੁੰਦੀ ਸੀ ਉਹਨਾਂ ਦਿਨਾਂ ਵਿੱਚ ਉਹਨਾਂ ਜ਼ਮਾਨਿਆਂ ਵਿੱਚ ਕੀ ਹੁੰਦਾ ਸੀ ਕਿ ਜਿਹੜੀ ਸਵਾਣੀਆਂ ਹੁੰਦੀਆਂ ਸੀ ਨਲਕੇ ਵਿੱਚੋਂ ਪਾਣੀ ਨਲਕਾ ਗੇੜ ਕੇ ਉਹਦੇ ਵਿੱਚੋਂ ਪਾਣੀ ਲੈਂਦੀਆਂ ਸਨ ਅਤੇ ਉਹੀ ਪਾਣੀ ਪੀਣ ਲਈ ਵਰਤਿਆ ਜਾਂਦਾ ਸੀ ਸਾਰੇ ਘਰ ਦੇ ਕੰਮ ਉਸੇ ਪਾਣੀ ਨਾਲ ਹੀ ਕੀਤੇ ਜਾਂਦੇ ਹਨ ਅੱਜ ਕੱਲ੍ਹ ਦੇ ਦੌਰ ਵਿੱਚ ਪਾਣੀ ਦੀ ਇੱਕ ਤਾਂ ਕਿੱਲਤ ਬਹੁਤ ਹੋ ਚੁੱਕੀ ਹੈ ਕਿਉਂਕਿ ਜਿਹੜੇ ਲੋਕ ਹਨ ਉਹ ਪਾਣੀ ਨੂੰ ਬਹੁਤ ਹੀ ਬਰਬਾਦ ਕਰਦੇ ਹਨ ਲੋਕਾਂ ਨੂੰ ਆਦਤ ਪੈ ਚੁੱਕੀ ਹੈ ਕਿ ਅਗਰ ਪਾਣੀ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਵੀ ਹੈਗੀ ਫਿਰ ਵੀ ਉਹ ਟੂਟੀਆਂ ਖੁੱਲ੍ਹੀਆਂ ਛੱਡਦੇ ਹਨ ਅਤੇ ਪਾਣੀ ਜਿਹੜਾ ਹੈ ਉਹ ਗੈਰ ਜ਼ਰੂਰੀ ਕੰਮਾਂ 'ਤੇ ਵਰਤਦੇ ਹਨ ਜਿਵੇਂ ਕਿ ਆਪਣੀਆਂ ਗੱਡੀਆਂ ਧੋਣੀਆਂ ਅਤੇ ਔਰ ਉਹ ਗੱਡੀਆਂ ਵੀ ਧੋਂਦੇ ਕਿੱਦਾਂ ਨੇ ਪਾਈਪਾਂ ਲਗਾ ਕੇ ਪਾਣੀ ਦੀਆਂ ਔਰ ਇੰਨਾ ਇੰਨਾ ਪਾਣੀ ਛੱਡਦੇ ਹਨ ਕਈ ਇਲਾਕੇ ਐਸੇ ਵੀ ਹਨ ਜਿਹਨਾਂ ਵਿੱਚ ਕਿ ਪਾਣੀ ਦੀ ਕਮੀ ਬਹੁਤ ਹੈ ਪਾਣੀ ਮਿਲਦਾ ਹੀ ਨਹੀਂ ਹੈ ਸੁੱਚੀ ਮੁਹੱਬਤ ਅਤੇ ਜ਼ਿੱਦ ਅਤੇ ਜਨੂੰਨ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਪਹਾੜ ਦੀ ਛਾਤੀ 'ਤੇ ਇਤਿਹਾਸ ਲਿਖਣ ਵਾਲੇ ਬਿਹਾਰ ਦੇ ਸ਼ਾਹ ਜਹਾਂ ਦਸ਼ਰਤ ਮਾਂਜੀ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਜਿਹਨਾਂ ਨੇ ਸਿਰਫ ਹਥੌੜੇ ਛੈਣੀ ਦੀ ਮਦਦ ਨਾਲ ਇੱਕ ਪਥਰੀਲੇ ਪੜਾਅ ਦਾ ਸੀਨਾ ਇਸ ਕਰਕੇ ਵਿਚਾਲਿਓਂ ਪਾੜ ਦਿੱਤਾ ਕਿ ਉਹ ਪਹਾੜ ਇੱਕ ਦਿਨ ਉਹਨਾਂ ਦੀ ਪਤਨੀ ਦੀ ਮੌਤ ਦਾ ਕਾਰਨ ਬਣਿਆ ਸੀ ਇਸ ਦੌਰਾਨ ਭਾਗੀਰਥ ਨੇ ਦੱਸਿਆ ਕਿ ਉਹ ਬੇਹੱਦ ਮਾਣ ਮਹਿਸੂਸ ਕਰਦਾ ਹੈ ਕਿ ਉਸ ਦੇ ਪਿਤਾ ਨੇ ਆਪਣੇ ਜੀਵਨ ਵਿੱਚ ਅਜਿਹਾ ਕਾਰਨਾਮਾ ਕਰ ਵਿਖਾਇਆ ਜਿਸ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ ਉਸ ਦੇ ਅਨੁਸਾਰ ਉਸ ਦੀ ਮਾਈ ਦੀ ਮੌਤ ਕਾਰਨ ਬਣੇ ਉਸ ਕੁਲਹਿਣੇ ਪਹਾੜ ਨੂੰ ਜੜ੍ਹ ਤੋਂ ਖਦੇੜ ਕੇ ਉਸ ਦੇ ਪਿਤਾ ਨੇ ਆਪਣੀ ਪਤਨੀ ਦੀ ਮੌਤ ਦਾ ਬਾਈ ਸਾਲਾਂ ਬਾਅਦ ਬਦਲਾ ਲਿਆ ਉਹਨਾਂ ਦੀ ਇਸ ਕਾ ਜਨੂੰਨੀ ਮੁਹੱਬਤ ਕਰਕੇ ਉਹਨਾਂ ਨੂੰ ਬਿਹਾਰ ਦਾ ਸ਼ਾਹ ਜਹਾਂ ਵੀ ਆਖਿਆ ਜਾਂਦਾ ਹੈ ਉਸ ਨੇ ਦੱਸਿਆ ਕਿ ਇਸ ਪਹਾੜ ਨੂੰ ਕੱਟ ਕੇ ਉਸ ਦੇ ਪਿਤਾ ਨੇ ਉਕਤ ਇਲਾਕੇ ਦੇ ਲੋਕਾਂ ਲਈ ਖਾਸ ਕਰਕੇ ਸਿਹਤ ਸਹੂਲਤਾਂ ਵਾਲੇ ਸ਼ਹਿਰ ਨੂੰ ਜਾਣ ਦਾ ਸਿੱਧਾ ਰਸਤਾ ਬਣਾ ਦਿੱਤਾ ਤਾਂ ਜੋ ਭਵਿੱਖ ਵਿੱਚ ਲੋਕਾਂ ਨੂੰ ਇਸ ਪਹਾੜ ਕਰਕੇ ਆਪਣੀ ਜਾਨ ਨਾ ਗੁਆਉਣੀ ਪਵੇ ਦੇਸ਼ ਦੇ ਸਭ ਤੋਂ ਵੱਡੇ ਸੂਬਿਆਂ 'ਚੋਂ ਇੱਕ ਬਿਹਾਰ ਦੇ ਜ਼ਿਲ੍ਹੇ ਗਇਆ ਅਧੀਨ ਪੈਂਦੇ ਪਿੰਡ ਗਹਿਲੌਰ ਦੇ ਮੁਸਹਰ ਪਰਿਵਾਰ 'ਚ ਪੈਦਾ ਹੋਏ ਦਸ਼ਰਤ ਮਾਂਜੀ ਛੋਟੀ ਉਮਰ 'ਚ ਹੀ ਆਪਣਾ ਘਰ ਛੱਡ ਕੇ ਚਲੇ ਗਏ ਸਨ ਲੰਮਾ ਸਮਾਂ ਧੰਨਵਾਦ ਵਿਖੇ ਕੋਲੇ ਦੀਆਂ ਖਾਣਾਂ 'ਚ ਕੰਮ ਕਰਨ ਉਪਰੰਤ ਉਹ ਮੁੜ ਆਪਣੇ ਪਿੰਡ ਗਹਲੋਰ ਵਾਪਸ ਆ ਗਏ ਉੱਨੀ ਸੋ ਪਚਾਨਵੇਂ ਵਿੱਚ ਦਸ਼ਰਤ ਮਾਂਜੀ ਦਾ ਵਿਆਹ ਫਾਲਗੁਨੀ ਦੇਵੀ ਨਾਲ ਹੋਇਆ ਜੋ ਕਿ ਦਸ਼ਰਤ ਮਾਂਜੀ ਦੇ ਬਚਪਨ ਦਾ ਪਿਆਰ ਸੀ ਵਿਆਹ ਮਗਰੋਂ ਪਰਿਵਾਰ ਦੇ ਪਾਲਣ ਪੋਸ਼ਣ ਲਈ ਦਸ਼ਰਤ ਮਾਂਜੀ ਆਪਣੇ ਪਿੰਡ ਦੇ ਕੋਲ ਹੀ ਕਿਸੇ ਦੇ ਖੇਤਾਂ 'ਚ ਮਜ਼ਦੂਰੀ ਕਰਨ ਲੱਗ ਪਏ ਜੋ ਉੱਚੇ ਲੰਮੇ ਪਥਰੀਲੇ ਪਹਾੜ ਦੇ ਦੂਜੇ ਪਾਸੇ ਸੀ ਉਹਨਾਂ ਦੀ ਪਤਨੀ ਰੋਜ਼ਾਨਾ ਹੀ ਦਸ਼ਰਤ ਮਾਂਜੀ ਨੂੰ ਖਾਣਾ ਦੇਣ ਲਈ ਉਸ ਪਹਾੜ ਨੂੰ ਪਾਰ ਕਰਕੇ ਖੇਤਾਂ 'ਚ ਜਾਂਦੀ ਸੀ ਜਦੋਂ ਉਹ ਦੂਜੀ ਵਾਰ ਗਰਭਵਤੀ ਸੀ ਤਾਂ ਉਹ ਆਮ ਦਿਨਾਂ ਵਾਂਗ ਹੀ ਆਪਣੇ ਪਤੀ ਨੂੰ ਭੋਜਨ ਦੇਣ ਲਈ ਪਹਾੜਾਂ 'ਤੇ ਚੜ੍ਹਨ ਲੱਗੀ ਤਾਂ ਇਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਹੇਠਾਂ ਡਿੱਗ ਪਈ ਜਿਸ ਨਾਲ ਉਸ ਦੀ ਹਾਲਤ ਬੇਹਦ ਗੰਭੀਰ ਬਣ ਗਈ ਉਸ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਉਹ ਪਹਾੜ ਵਿਚਲੇ ਹੋਣ ਕਰਕੇ ਉਸ ਦਾ ਇਲਾਜ ਸਮੇਂ ਸਿਰ ਨਾ ਹੋ ਸਕਿਆ ਧੰਨਵਾਦ